ਸਿਲਾਈ ਅਤੇ ਬੁਣਾਈ ਸ਼ੁਰੂ ਤੋਂ ਹੀ ਮੇਰਾ ਇੱਕ ਸ਼ੌਂਕ ਰਿਹਾ ਹੈ ਕਿਉਂਕਿ ਮੈਂ ਆਪਣੇ ਬਚਪਨ ਤੋਂ ਹੀ ਆਪਣੀ ਮੰਮੀ ਨੂੰ ਇਹ ਕੰਮ ਕਰਦਾ ਵੇਖਦੀ ਆਈ ਹਾਂ ਅਤੇ ਉਹਨਾਂ ਨੂੰ ਵੇਖ ਵੇਖ ਕੇ ਹੀ ਮੈਨੂੰ ਵੀ ਇਹ ਕੰਮ ਆ ਗਿਆ ਅਤੇ ਹੁਣ ਮੈਂ ਆਪ ਵੀ ਇਸ ਕੰਮ ਨੂੰ ਕਰਦੀ ਹਾਂ ਸਿਲਾਈ ਦੇ ਕੰਮ ਵਿੱਚ ਸਾਨੂੰ ਬਹੁਤ ਸਾਰੇ ਸਾਧਨਾਂ ਦੀ ਲੋੜ ਹੁੰਦੀ ਹੈ ਇਹ ਨਿੱਕੇ ਜਾਂ ਵੱਡੇ ਸਾਧਨ ਹੀ ਇਸ ਕੰਮ ਨੂੰ ਸੌਖਾ ਜਾਂ ਔਖਾ ਬਣਾਉਂਦੇ ਹਨ ਇਹਨਾਂ ਸਾਧਨਾਂ ਵਿੱਚੋਂ ਇੱਕ ਹੈ